ਹੈਲੋ ਸਸਰੀ ਕਾਲ ਜੀ ਹਾਂ ਜੀ ਹਾਂ ਸਾਡੀ ਡੈਰੀ ਐ ਬਠਿੰਡਾ ਰੋਡ ਤੇ ਸਨੇਕ ਡੈਰੀ ਬਹੁਤ ਮਸ਼ਹੂਰ ਐ ਉਥੇ ਬੋਲਦੇ ਆਂ ਜੀ ਸਾਡੇ ਦੁੱਧ ਦਈ ਘਿਓ ਬਿਸਕੁਟ ਕਰੀਮ ਆਲੀ ਐਸਕਰੀਮ ਠੰਢੇ ਤੱਤੇ ਸਾਰਾ ਕੁਝ ਹੀ ਮਿਲਦਾ ਐ ਤੇ ਵਧੀਆ ਤਾਜਾ ਸਮਾਨ ਐਨ ਆਪਦਾ ਬਣਾਉਣੇ ਆਪਦਾ ਤਿਆਰ ਕਰਦੇ ਅਸੀਂ ਜਿਹੜਾ ਵਧੀਆ ਖਾਸ ਦੁੱਧ ਜਿਵੇਂ ਮੱਝ ਦਾ ਚੁਆਵਾਂ ਉਹ ਤਾਂ ਮਿਲੂਗਾ ਤੁਹਾਨੂੰ ਸੱਤਰ ਰੁਪਈਏ ਜਿਵੇਂ ਗਾਵਾਂ ਦਾ ਗਾਵਾਂ ਦਾ ਦੁੱਧ ਤੇ ਮੱਝਾਂ ਦਾ ਦੁੱਧ ਲਾ ਕੇ ਦੇ ਦਿੰਦੇ ਲੋਕ ਤੇ ਉਹ ਮਿਲੂਗਾ ਤੁਹਾਨੂੰ ਪਜਵੰਜਾ ਰੁਪਈਏੇ ਹਾਂ ਨਹੀਂ ਉਹਦੀ ਕੋਈ ਗਰੰਟੀ ਨੀ ਜਿਹੜਾ ਮੱਝ ਦਾ ਦੁੱਧ ਖਾਸ ਉਹਦੀ ਸੌ ਪਰਸੈਂਟ ਗਰੰਟੀ ਵਧੀਆ ਦੁੱਧ ਵਧੀਆ ਉੱਥੇ ਘਿਓ ਜਿੰਨਾ ਮਰਜੀ ਕੱਢੋ ਨਾ ਨਾ ਜੀ ਕਪ ਜੋ ਰੇਟ ਈ ਪੂਰਾ ਲੈਣਾ ਫੇਰ ਵਧੀਆ ਮੱਝ ਦਾ ਈ ਦਿਵਾਂਗੇ ਅੱਡ ਤੇ ਗਾਵਾਂ ਦਾ ਜਿਵੇਂ ਦੱਸ ਕੇ ਦਿਵਾਂਗੇ ਦੇਖੋ ਇਹ ਸਾਡੇ ਕੁਛ ਕਹਿਦੇ ਬਈ ਸਾਨੂੰ ਬੱਕਰੀ ਦਾ ਦੁੱਧ ਚਾਹੀਦਾ ਉਹ ਅਸੀਂ ਬਹੁਤ ਘੱਟ ਰੱਖਦੇ ਆਂ ਉਹ ਕੋਈ ਜਤਾਵਾਂਗਾ ਕਵਾਉਂਦਾ ਚੱਲ ਕੋ ਰੱਖਣਾ ਤਾਂ ਪੈਂਦਾ ਦੁਕਾਨਦਾਰੀ ਕਰਕੇ ਔਰ ਲਾਗਤ ਉਹ ਉਹਦਾ ਦੋ ਲਾ ਬੱਕਰੀ ਦੇ ਦੁੱਧ ਦੀ ਲਾਗਤ ਬਹੁਤ ਘੱਟ ਐ ਤੇ ਰੱਖਣਾ ਪੈਂਦਾ ਹਾਂ ਰੱਖਣਾ ਪੈਂਦਾ ਦੁਕਾਨਦਾਰੀ ਦੇ ਵਿੱਚ ਰੱਖਣਾ ਪੈਂਦਾ ਬਸ ਘਿਓ ਵੀ ਘਿਓ ਜਿਹੜਾ ਵਧੀਆ ਆਪਦਾ ਬਣਾਇਆ ਸਰੀ ਆਪਦਾ ਉਹ ਦਿਨੇ ਛੇ ਸੌ ਰੁਪਈਏ ਕਿਲੋ ਤੇ ਦਹੀ ਜਿਹੜੀ ਆਪਦੀ ਬਣਾਉਣੇ ਅਸੀਂ ਆਪ ਵਧੀਆ ਉਹ ਦਿਨੇ ਆ ਅਸੀਂ ਸੱਠ ਰੁਪਈਏ

ਬਹੁਤ ਵਧੀਆ ਕੋਈ ਲਾਂਭਾ ਨੀ ਕੋਈ ਖੱਟੀ ਨੀ ਆਪ ਆਪਦੀ ਤਿਆਰ ਕੀਤੀ ਹੋਈ ਨਹੀਂ ਨਹੀਂ ਜੀ ਇਹ ਤਾਂ ਪਹਿਲਾਂ ਹੀ ਇਹ ਕੰਮ ਤੋਂ ਡਰਦੇ ਆਂ ਚੀਜ ਵੇਚ ਲਓ ਘੱਟ ਵੇਚ ਲਓ ਤੇ ਮੁੜ ਕੇ ਨਫਾ ਨੁਕਸਾਨ ਦੁਬਾਰਾ ਬਹੁਤ ਭਰਨਾ ਔਖਾ ਨਾਲੇ ਲੋਕ ਦਿਵਾਂਗੇ ਬੱਚਿਆਂ ਦੀ ਐਟਮਾਂ ਹਾਂ ਛੋਟੇ ਐਸਕਰੀਮ ਬਿਸਕੁਟ ਚੌਕਲੇਟ ਐਸਕਰੀਮ ਠੰਡੇ ਕੋਕਾ ਕੋਲਾ ਨਿੱਕੇ ਜੇ ਬੱਚਿਆਂ ਦੇ ਖਾਣ ਪੀਣ ਆਲੀਆਂ ਚੀਜ਼ਾਂ ਸਾਰੀਆਂ ਹੀ ਮਿਲਦੀਆਂ ਇੱਥੇ ਵਧੀਆ ਚ ਹਾਂ ਠੀਕ ਆ ਕੰਮ ਵਧੀਆ ਚੰਗਾ ਸਮਾਨ ਦੇਨ ਤੇ ਸਿਰ ਤੇ ਈ ਕੰਮ ਚੰਗਾ ਚਲਦਾ ਹਾਂ ਹੋਰ ਠੀਕ ਆ ਵਧੀਆ ਆਪਦਾ ਕੰਮ ਚੰਗਾ ਚੱਲੀ ਜਾਂਦਾ ਵਧੀਆ ਅਸੀਂ ਚੁਆਵਾਂ ਦੁੱਧ ਆਪ ਲਿਆਉਣੇ ਨਾਲ ਜਾ ਕੇ ਬੰਦੇ ਸਾਡੇ ਜਾਂਦੇ ਆ ਆਪ ਮੱਝਾਂ ਚੌ ਕੇ ਲਿਆਉਂਦੇ ਉਹਨਾਂ ਦੀਆਂ ਕੋਲੇ ਖੜ੍ਹਕੇ

ਨਹੀ ਨਹੀਂ ਉਹ ਨਹੀਂ ਗਾਈਆਂ ਦਾ ਨੀ ਅਸੀਂ ਤਾਂ ਪਿੰਡਾਂ ਚ ਜਾਨਾ ਆ ਪਿੰਡਾਂ ਦੇ ਵਿੱਚੋਂ ਲੋਕਾਂ ਦੇ ਦਸ ਦਸ ਪੰਦਰਾਂ ਪੰਦਰਾਂ ਮੱਝਾਂ ਰੱਖੀਆਂ ਘਰਾਂ ਚ ਉਹ ਸਾਡੇ ਬੰਦੇ ਜਾਂਦੇ ਆਪ ਕੋਲੇ ਖੜ੍ਹ ਕੇ ਚੁਆ ਕੇ ਫੈਂਟ ਕੱਢ ਕੇ ਭੋਰਾ ਭੋਰਾ ਫੈਂਟ ਕੱਢ ਕੇ ਫੇਰ ਲੈਨੇ ਆ ਨਹੀਂ ਤਾਂ ਮਾੜਾ ਦੁੱਧ ਨੀ ਚੱਕਦੇ

ਫੇਰ ਹਾਂ ਨਹੀਂ ਆਓ ਜੀ ਆਇਆ ਨੂੰ ਠੀਕ ਐ